ਮੇਰੀ ਮਨ ਪਸੰਦ ਚਿੱਤਰਕਾਰੀ ਸ਼ੈਲੀ ਪੈਂਸਿਲ ਆਰਟ ਹੈ ਇਸ ਨੂੰ ਬਣਾਉਣ ਵਿੱਚ ਇੱਕ ਤਾਂ ਸਮੇਂ ਦੀ ਬਹੁਤ ਹੀ ਘੱਟ ਵਰਤੋਂ ਹੁੰਦੀ ਹੈ ਅਤੇ ਰੰਗਾਂ ਦਾ ਇਸਤੇਮਾਲ ਬਹੁਤ ਹੀ ਘੱਟ ਕੀਤਾ ਜਾਂਦਾ ਹੈ ਅਤੇ ਕੋਈ ਖਾਸ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਪੈਂਦੀ ਇਸ ਨੂੰ ਬਣਾਉਣ ਲਈ ਇੱਕ ਪੈਂਸਿਲ ਅਤੇ ਇੱਕ ਕਾਗਜ਼ ਦੀ ਹੀ ਜ਼ਰੂਰਤ ਪੈਂਦੀ ਹੈ ਔਰ ਇਹ ਬਹੁਤ ਘੱਟ ਸਮੇਂ ਵਿੱਚ ਬਹੁਤ ਸੌਖੇ ਢੰਗ ਨਾਲ ਤਿਆਰ ਹੋ ਜਾਂਦੀ ਹੈ ਅਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਇਸ ਨਾਲ ਪੇਂਟਿੰਗ ਵਿੱਚ ਨਿਖਾਰ ਵੀ ਆਉਂਦਾ ਹੈ ਅਤੇ ਬਹੁਤ ਸੁੰਦਰ ਵੀ ਲੱਗਦੀ ਹੈ ਤਕ ਬਹੁਤੀ ਤੌਰ ਉੱਤੇ ਪੈਂਸਿਲ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਚਿੱਤਰਕਾਰੀ ਵਿੱਚ ਨਿਖਾਰ ਆ ਸਕੇ ਸੁੰਦਰਤਾ ਆ ਸਕੇ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾ ਸਕੇ ਅਤੇ ਇਹ ਲੋਕਾਂ ਦੁਆਰਾ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਚਿੱਤਰਕਾਰੀ ਸ਼ੈਲੀ ਹੈ ਧੰਨਵਾਦ